ਹੈਲੋ ਹਾਂਜੀ ਹਾਂਜੀ ਮੈਂ ਸੰਜੀਵ ਜੀ ਬੋਲ ਰਿਹਾ ਹਾਂਜੀ ਅੱਛਾ ਜੀ ਦੇਖੋ ਇੱਕ ਤਾਂ ਪੰਜਾਬ ਅ ਪੰਜਾਬੀ ਯੂਨੀਵਰਸਿਟੀ ਹੈ ਹੈ ਨਾ ਜੋ ਕਿ ਜੋ ਕਿ ਪਟਿਆਲਾ ਵਿੱਚ ਹੈ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਪੰਜਾਬ ਟੈਕਨੀਕਲ ਯੂਨੀਵਰਸਿਟੀ ਜੋ ਕਿ ਕਪੂਰਥਲੇ ਹੈ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਜੋ ਕਿ ਬਠਿੰਡੇ ਹੈ ਥਾਪਰ ਯੂਨੀਵਰਸਿਟੀ ਵੀ ਪਟਿਆਲੇ ਹੈ ਇੱਕ ਚਿਤਕਾਰਾ ਚਿਤਕਾਰਾ ਯੂਨੀਵਰਸਿਟੀ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਅਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਜੀ ਦੇਖੋ ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਠੀਕ ਹੈ ਜੀ ਇਹ ਇਹ ਇਹ ਅਤੇ ਇੱਕ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਅ ਪੀ ਟੀ ਯੂ ਇਹ ਸਾਰੀ ਸਰਕਾਰੀ ਨੇ ਅਤੇ ਐੱਲ ਪੀ ਯੂ ਅਤੇ ਚਿਤਕਾਰਾ ਯੂਨੀਵਰਸਿਟੀ ਆ ਇੱਕ ਅ ਥਾਪਰ ਯੂਨੀਵਰਸਿਟੀ ਹੈ ਇਹ ਸਭ ਪ੍ਰਾਈਵੇਟ ਨੇ ਬੰਦਾ ਸਿੰਘ ਬਹਾਦਰ ਇੰਜੀਨੀਅਰ ਕੋਲਜ 'ਚ ਪੜ੍ਹਦੇ ਹਾਂ ਅਤੇ ਇਹ ਜਿਹੜਾ ਕੋਲਜ ਹੈ ਇਹ ਪੰਜਾਬ 'ਚ ਕਈ ਯੂਨੀਵਰਸਿਟੀ ਨਾਲ ਐਫੀਲੇਟਿਡ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਫਤਿਹਗੜ੍ਹ ਸਾਹਿਬ ਵਿੱਚ ਹੈ ਹਾਂਜੀ ਪਟਿਆਲੇ ਤੋਂ ਚਾਲੀ ਹਾਂ ਇਸ ਪਲੇਸਮੈਂਟ ਕਾਫੀ ਨੇ ਜਿਹੜੀਆਂ ਸਭ ਤੋਂ ਜ਼ਿਆਦਾ ਜਿਹੜੀ ਪਲੇਸਮੈਂਟ ਹੈ ਉਹ ਥਾਪਰ ਯੂਨੀਵਰਸਿਟੀ 'ਚ ਹੁੰਦੀ ਹੈ ਅਤੇ ਅਤੇ ਮੈਨੂੰ ਲੱਗਦਾ ਮੈਂ ਇਸ ਕਾਲਜ 'ਚ ਮੇਰੀ ਪਲੇਸਮੈਂਟ ਹੋਜੂਗੀ ਕਿਉਂਕਿ ਮੇਰੇ ਚੰਗੇ ਮਾਰਕਸ ਨੇ ਅਤੇ ਮੈਨੂੰ ਹਾਂਜੀ ਹਾਂਜੀ ਹਾਂਜੀ ਤੁਸੀਂ ਤੁਸੀਂ ਤੁਹਾਡੇ ਕੋਲ ਪੈਸੇ ਹੈ ਤਾਂ ਤੁਸੀਂ ਥਾਪਰ ਯੂਨੀਵਰਸਿਟੀ 'ਚ ਲੈ ਲਉ ਹੈ ਨਾ ਜੀ ਥਾਪਰ ਯੂਨੀਵਰਸਿਟੀ 'ਚ ਕਹਿੰਦੇ ਪੈਕਜ ਵਧੀਆ ਮਿਲ ਜਾਂਦਾ ਹੈ ਅਤੇ ਫੀਸ ਕਾਫੀ ਹੈ ਅਤੇ ਹਾਂਜੀ ਹਾਂਜੀ ਹਾਂਜੀ ਓਕੇ ਜੀ ਓਕੇ